ਅੱਜ ਕੱਲ੍ਹ ਅਸੀਂ ਦੇਖਦੇ ਹਾਂ ਕਿ ਲੋਕ ਬਹੁਤ ਜ਼ਿਆਦਾ ਹੀ ਕਲਾਤਮਿਕ ਹੋ ਗਏ ਹਨ ਲੋਕ ਕਈ ਕਈ ਤਰ੍ਹਾਂ ਚੀਜ਼ਾਂ ਵੱਖ ਵੱਖ ਬਣਾਉਂਦੇ ਰਹਿੰਦੇ ਹਨ ਜਿਵੇਂ ਕਿ ਮਿੱਟੀ ਦੇ ਭਾਂਡੇ ਲੋਹੇ ਤੋਂ ਵੱਖ ਵੱਖ ਚੀਜ਼ਾਂ ਜੋ ਕਿ ਦੇਖਣ ਦੇ ਵਿੱਚ ਬਹੁਤ ਹੀ ਖੂਬਸੂਰਤ ਲੱਗਦੀਆਂ ਹਨ ਅਸੀਂ ਦੇਖਦੇ ਹਾਂ ਕਿ ਜਦੋਂ ਘੁਮਿਆਰ ਮਿੱਟੀ ਦੇ ਵੱਖਰੇ ਵੱਖਰੇ ਭਾਂਡੇ ਬਣਾਉਂਦਾ ਹੈ ਤਾਂ ਉਸਦੇ ਉੱਪਰ ਬਹੁਤ ਹੀ ਸਫਾਈ ਦੇ ਨਾਲ ਚਿੱਤਰ ਬਣਾਉਂਦਾ ਹੈ ਉਹਨੂੰ ਅਲੱਗ ਅਲੱਗ ਸਜਾਵਟ ਸਜਾਵਟ ਕਰਦਾ ਹੈ ਅਤੇ ਉਹ ਦੇਖਣ ਦੇ ਵਿੱਚ ਵੀ ਬਹੁਤ ਜ਼ਿਆਦਾ ਸੁੰਦਰ ਦਿਖਾਈ ਦਿੰਦੇ ਹਨ ਜਿਵੇਂ ਕਿ ਅਸੀਂ ਵੇਖਦੇ ਹਾਂ ਪਿੰਡਾਂ ਦੇ ਵਿੱਚ ਕਿ ਘੜੇ ਹੁੰਦੇ ਹਨ ਘੜੇ ਨੂੰ ਇੰਨੀ ਵਧੀਆ ਉਹਨਾਂ ਨੇ ਆਕਾਰ ਦਿੱਤਾ ਹੁੰਦਾ ਹੈ ਉਸ ਦੇ ਉੱਤੇ ਬਹੁਤ ਹੀ ਸੋਹਣਾ ਰੰਗ ਕੀਤਾ ਹੁੰਦਾ ਹੈ ਅਤੇ ਬਹੁਤ ਹੀ ਜ਼ਿਆਦਾ ਸੋਹਣੀ ਚਿੱਤਰ ਕ ਚਿੱਤਰਕਾਰੀ ਕੀਤੀ ਹੁੰਦੀ ਹੈ ਜੋ ਕਿ ਦੇਖਣ ਦੇ ਵਿੱਚ ਬਹੁਤ ਹੀ ਵਧੀਆ ਲੱਗਦੀ ਹੈ ਜੇ ਅਸੀਂ ਉਸ ਵਿੱਚ ਪਾਣੀ ਰੱਖਦੇ ਹਾਂ ਤਾਂ ਉਹ ਪਾਣੀ ਇੱਕ ਤਾਂ ਸਾਫ ਸੁਥਰਾ ਰਹਿੰਦਾ ਹੈ ਅਤੇ ਪੀਣ ਦੇ ਵਿੱਚ ਵੀ ਵਧੀਆ ਹੁੰਦਾ ਹੈ ਅਤੇ ਉਸ ਵਿੱਚ ਕੋ ਓ ਉਹ ਉਹਦੇ ਵਿੱਚ ਵੀ ਇੱਕ ਠੰਡਾਪਣ ਮਿੱਟੀ ਦਾ ਵੱਖਰਾ ਹੀ ਹੁੰਦਾ ਹੈ